ਭੰਗੜਾ ਬਹੁਤ ਹੀ ਸਦੀ ਗੇਮ ਟੀਮ ਹੈ ਔਰ ਇਸ ਟੀਮ ਦੇ ਵਿੱਚ ਪੂਰੇ ਬੋਲੀਆਂ ਪਾਉਣ ਵਾਲਾ ਔਰ ਇਹਦੇ ਵਿੱਚ ਕਾਟੋ ਵਾਲਾ ਅਤੇ ਇਹਦੇ 'ਚ ਜਿਹੜਾ ਹੈ ਹਰੇਕ ਤਰ੍ਹਾਂ ਦੀ ਜਿਹੜਾ ਸਾਜ ਇਹਦੇ 'ਚ ਵੱਜਦਾ ਹੈ ਔਰ ਖ਼ਾਸ ਕਰਕੇ ਜਿਹੜਾ ਮੇਨ ਹੈ ਉਹ ਢੋਲ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਢੋਲੀ ਹੈ ਉਹ ਇਸ ਢੰਗ ਦੇ ਨਾਲ ਬੋਲੀਆਂ ਪਾਉਂਦਾ ਅਤੇ ਉਹ ਪੂਰੇ ਪੰਡਾਲ ਨੂੰ ਨੱਚਣ ਲਗਾ ਦਿੰਦਾ ਹੈ ਅਤੇ ਪਹਿਰਾਵਾ ਇਹਨਾਂ ਦਾ ਜਿਵੇਂ ਮੈਂ ਦੱਸਿਆ ਕਿ ਪੱਗ ਫੁਰਲੇ ਵਾਲੀ ਤੁਰਲੇ ਵਾਲੀ ਪੱਗ ਲੜ ਛੱਡਵੀਂ ਅਤੇ ਉਹਦੇ ਨਾਲ ਕੁੜਤਾ ਕਲੀਆਂ ਵਾਲਾ ਕੁੜਤਾ ਅਤੇ ਨਾਲ ਉਹਨਾਂ ਦੇ ਉੱਤੇ ਜਾਕਟ ਅਤੇ ਖੁੱਲ੍ਹਾ ਚਾਦਰਾ ਜਿਹੜਾ ਇਹਦੀ ਸ਼ਾਨ ਹੈ ਔਰ ਇਹ ਕੱਢਵੀਂ ਜੁੱਤੀ ਪਾ ਕੇ ਕਿਤੇ ਵੀ ਵੱਡਿਆਂ ਇਕੱਠਾਂ ਦੇ ਵਿੱਚ ਜਾ ਹੋ ਕਿਤੇ ਵੀ ਭੀੜ ਦੇ ਵਿੱਚ ਅਲੱਗ ਹੀ ਨਜ਼ਰ ਆਉਂਦੇ ਆ ਉਹਨਾਂ ਦਾ ਜਿਹੜਾ ਹੈ ਉਹ ਬਹੁਤ ਹੀ ਪ੍ਰਭਾਵੀ ਔਰ ਪ੍ਰਭਾਵਸ਼ਾਲੀ ਹੁੰਦਾ ਆ ਓ ਦੂਸਰਾ ਜਿਹੜਾ ਇਹ ਡਾਂਸ ਹੈ ਡਾਂਸ ਜਿਹੜੀ ਉਹ ਅਲੱਗ ਚੀਜ਼ ਹੈ ਉਹ ਜੋ ਕਲਾਕਾਰ ਜਿਹੜੇ ਐਕਟਰ ਹੈਗੇ ਆ ਉਹ ਡਾਂਸ ਉਹ ਕਰਦੇ ਆ ਜਿਹੜਾ ਪੰਜਾਬ ਦਾ ਭੰਗੜਾ ਪੰਜਾਬ ਦੀਆਂ ਬੋਲੀਆਂ ਇਹ ਅਲੱਗ ਕਿਸਮ ਦੀਆਂ ਜਿਹੜੀਆਂ ਹੈ ਹੈਗੀਆਂ ਔਰ ਇਹਦੇ ਨਾਲ ਬੋਲੀਆਂ ਦੇ ਨਾਲ ਬਹੁਤ ਹੀ ਵਧੀਆ ਭੰਗੜੇ ਪਾਏ ਜਾਂਦੇ ਹੈ ਔਰ ਕੁੜੀਆਂ ਜਿਹੜੀਆਂ ਗਿੱਧੇ ਪਾਉਂਦੀਆਂ ਹੈ ਔਰ ਗੱਭਰੂ ਪੰਜਾਬ ਦਾ ਭੰਗੜਾ ਪਾਉਂਦੇ ਹੈ ਔਰ ਭੰਗੜੇ ਦੇ ਵਿੱਚ ਚਾਰ ਚੰਨ ਲਗਾਉਂਦੇ ਹੈ ਔਰ ਬਹੁਤ ਹੀ ਲੋਕ ਖੁਸ਼ ਹੋ ਕੇ ਬੱਕਰੇ ਬੁਲਾਉਂਦੇ ਬੱਗੀਆਂ ਪਾਉਂਦੇ ਲਲਕਾਰੇ ਮਾਰਦੇ